ਦੋ ਜਨਵਰੀ ਉੱਨੀ ਸੌ ਤਰਾਸੀ ਅੱਠ ਨਵੰਬਰ ਉੱਨੀ ਸੌ ਅਠਾਸੀ ਪੰਜ ਨਵੰਬਰ ਉੱਨੀ ਸੌ ਇਕਿਆਸੀ ਸਤਾਈ ਦਸੰਬਰ ਦੋ ਹਜ਼ਾਰ ਬਾਈ ਅਤੇ ਸੱਤ ਜਨਵਰੀ ਉੱਨੀ ਸੌ ਚਰੁਨਜਾ